ਡੇਂਗੂ ਬੁਖਾਰ ਅਤੇ ਮਲੇਰੀਆ ਇਹ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਹਨ ਡੇਂਗੂ ਬਹੁਤ ਹੀ ਜਾਨਲੇਵਾ ਹੈ ਇਸ ਦੇ ਨਾਲ ਸਰੀਰ ਦੇ ਸੈੱਲ ਬਹੁਤ ਘੱਟ ਜਾਂਦੇ ਹਨ ਅਤੇ ਕਈ ਵਾਰ ਇਹਨਾਂ ਦੀ ਪੂਰਤੀ ਨਾ ਹੋਣ ਕਰਕੇ ਮੌਤ ਵੀ ਹੋ ਸਕਦੀ ਹੈ ਸੋ ਸਾਨੂੰ ਜਿਹੜਾ ਹੈ ਇਹਨਾਂ ਬਿਮਾਰੀਆਂ ਤੋਂ ਬਚਣ ਲਈ ਸਹੀ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ ਇਹਨਾਂ ਬਿਮਾਰੀਆਂ ਦਾ ਖਾਸ ਕਾਰਨ ਹੈ ਮੱਛਰ ਦੁਆਰਾ ਕੱਟਣਾ ਸੋ ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕਣ ਲਈ ਸਾਨੂੰ ਘਰ ਦੀ ਅਤੇ ਆਪਣੇ ਆਲੇ ਦੁਆਲੇ ਦੀ ਸਫਾਈ ਵੱਲ ਖਾਸ ਧਿਆਨ ਰੱਖਣਾ ਚਾਹੀਦਾ ਮੱਛਰ ਪੈਦਾ ਹੁੰਦੇ ਹਨ ਕੂੜੇ 'ਤੇ ਜਾਂ ਫਿਰ ਖੜ੍ਹੇ ਪਾਣੀ 'ਤੇ ਸੋ ਕਿਤੇ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪਾਣੀ ਜ਼ਿਆਦਾ ਦਿਨ ਤੱਕ ਖੜ੍ਹਾ ਨਾ ਰਹੇ ਚਾਹੇ ਉਹ ਮੀਂਹ ਦਾ ਪਾਣੀ ਹੋਵੇ ਜਾਂ ਘਰਾਂ ਦੀ ਸਾਫ ਸਫਾਈ ਕਰਕੇ ਬਾਹਰ ਨੂੰ ਜਾਂ ਕਿਤੇ ਰੋੜਿਆ ਗਿਆ ਪਾਣੀ ਹੋਵੇ ਮੀਂਹ ਦਾ ਪਾਣੀ ਹੋਵੇ ਜ਼ਿਆਦਾ ਦੇਰ ਤੱਕ ਖੜ੍ਹਾ ਨਹੀਂ ਰਹਿਣਾ ਚਾਹੀਦਾ ਅਤੇ ਮੱਛਰਾਂ ਤੋਂ ਬਚਣ ਲਈ ਹੋਰ ਵੀ ਕਈ ਉਪਰਾਲੇ ਕਰਨੇ ਚਾਹੀਦੇ ਹਨ ਜਿਵੇਂ ਕਿ ਘਰਾਂ ਦੇ ਵਿੱਚ ਅਸੀਂ ਵੱਖ ਵੱਖ ਤਰ੍ਹਾਂ ਦੇ ਉਹ ਲਗਾ ਸਕਦੇ ਹਾਂ ਮੱਛਰਦਾਨੀ ਦਾ ਯੂਜ ਵੀ ਕੀਤਾ ਜਾ ਸਕਦਾ ਹੈ ਮੱਛਰਦਾਨੀ ਜਿਹੜੀ ਆ ਉਹ ਕਿਹ ਬਿਨਾਂ ਕਿਸੇ ਮੈਡੀਸਨ ਤੋਂ ਵੀ ਆਪਣੇ ਆਪ ਨੂੰ ਸੌਣ ਲੱਗੇ ਮੱਛਰਦਾਨੀ ਦੇ ਵਿੱਚ ਰਹੀਏ ਅਤੇ ਮੱਛਰਾਂ ਦੇ ਕੱਟਣ ਤੋਂ ਬਚਿਆ ਜਾ ਸਕਦਾ ਪਰ ਮੱਛਰਦਾਨੀ ਤਾਂ ਆਪਾਂ ਸਿਰਫ ਰਾਤ ਵੇਲੇ ਹੀ ਯੂਜ ਕਰ ਸਕਦੇ ਹਾਂ ਦਿਨ ਵੇਲੇ ਮੱਛਰਾਂ ਤੋਂ ਬਚਣ ਲਈ ਓਡੋਮਾਸ ਜਾਂ ਕੁਛ ਅਜਿਹੀਆਂ ਕਰੀਮਾਂ ਦੀ ਵਰਤੋਂ ਬੱਚਿਆਂ 'ਤੇ ਖਾਸ ਕਰਕੇ ਕਰਨੀ ਚਾਹੀਦੀ ਹੈ ਕਿਉਂਕਿ ਬੱਚੇ ਜਿਹੜੇ ਹੈ ਉਹ ਪਾਰਕਾਂ ਦੇ ਵਿੱਚ ਖੇਡਣ ਜਾਂਦੇ ਆ ਅਤੇ ਪਾਰਕਾਂ ਦੇ ਵਿੱਚ ਹਰਿਆਲੀ ਦੇ ਵਿੱਚ ਕਿਸੇ ਵੇਲੇ ਮੱਛਰ ਹੁੰਦੇ ਹਨ ਉੱਥੇ ਹਿਊਮੇਡੀਟੀ ਹੁੰਦੀ ਉੱਥੇ ਮੱਛਰ ਹੁੰਦੇ ਹਨ ਸੋ ਬੱਚੇ ਜਦੋਂ ਵੀ ਘਰੋਂ ਬਾਹਰ ਖੇਡਣ ਜਾਣ ਖਾਸ ਤੌਰ 'ਤੇ ਸ਼ਾਮ ਦੇ ਵੇਲੇ ਉਦੋਂ ਬੱਚਿਆਂ ਨੂੰ ਓਡੋਮਾਸ ਜਾਂ ਕੁਛ ਅਜਿਹੀਆਂ ਕਰੀਮ ਤੇਲ ਜਿਹੜੇ ਕਿ ਮੱਛਰਾਂ ਤੋਂ ਬਚਾਉਂਦੇ ਹਨ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਆਲੇ ਦੁਆਲੇ ਦੀ ਸਾਫ ਸਫਾਈ ਦਾ ਖਾਸ ਖਿਆਲ ਰੱਖਣਾ ਚਾਹੀਦਾ ਕੂੜਾ ਜਿਹੜਾ ਹੈ ਉਹ ਗਿੱਲਾ ਅਤੇ ਸੁੱਕਾ ਕੂੜਾ ਵੱਖਰਾ ਰੱਖਣਾ ਚਾਹੀਦਾ ਹੈ ਜਿਵੇਂ ਕਿ ਸਾਡੇ ਪ੍ਰਧਾਨ ਮੰਤਰੀ ਜੀ ਨੇ ਵੀ ਗਾਂਧੀ ਜੀ ਦੇ ਜਨਮਦਿਨ 'ਤੇ ਸਵੱਛ ਭਾਰਤ ਅਭਿਆਨ ਦੀ ਮੁਹਿੰਮ ਚਲਾਈ ਸੀ ਉਹ ਕੂੜਾ ਅਲੱਗ ਅਲੱਗ ਕਰਕੇ ਰੱਖਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਅਜਿਹੀ ਥਾਂ 'ਤੇ ਰੱਖਣਾ ਚਾਹੀਦਾ ਢੱਕਣ ਵਾਲੇ ਕੂੜੇਦਾਨਾਂ ਦੇ ਵਿੱਚ ਤਾਂ ਕਿ ਗਲੀਆਂ ਵਿੱਚ ਇੱਧਰ ਉੱਧਰ ਕੁੱਤੇ ਉਹਨਾਂ ਨੂੰ ਨਾ ਖਿਲਾਰ ਸਕਣ ਅਤੇ ਬਿਮਾਰੀਆਂ ਤੋਂ ਬਚਿਆ ਜਾ ਸਕੇ